ਮੈਂ ਐਮਾਜ਼ੋਨ ਤੋਂ ਔਨਲਾਈਨ ਵੀ ਐੱਲ ਸੀ ਸੀ ਦੀ ਡਾਇਮੰਡ ਫੈਸ਼ੀਅਲ ਕਿੱਟ ਅਤੇ ਨਾਲ ਬਲੀਚ ਕਰੀਮ ਪਰਚੇਸ ਕੀਤੀ ਉਸ ਦੀ ਖਰੀਦ ਕਰਨ ਤੋਂ ਬਾਅਦ ਉਸ ਨੂੰ ਵਰਤੋਂ ਵਿੱਚ ਲਿਆਂਦਾ ਇਸ ਦੇ ਨਾਲ ਇਹਦੀ ਵਰਤੋਂ ਕਰਨ ਤੋਂ ਬਾਅਦ ਮੈਨੂੰ ਇਹ ਚੀਜ਼ ਮਹਿਸੂਸ ਹੋਈ ਵੀ ਇਹ ਦੇ ਨਾਲ ਗਲੋਅ ਵੀ ਜ਼ਿਆਦਾ ਆਇਆ ਫੇਸ 'ਤੇ ਅਤੇ ਉਸ ਤੋਂ ਬਾਅਦ ਸਕਿੱਨ ਦੇ ਵਿੱਚ ਜਿਹੜੇ ਦਾਗ ਧੱਬੇ ਸੀਗੇ ਉਹ ਵੀ ਖਤਮ ਹੋਏ ਫਿੱਕੇ ਪੈਗੇ ਸੀ ਕਾਫੀ ਹੱਦ ਤੱਕ ਅਤੇ ਇਸ ਕਰਕੇ ਇਹ ਪ੍ਰੋਡਕਟ ਮੈਨੂੰ ਵਧੀਆ ਲੱਗਿਆ